ਜਿਵੇਂ ਕਿ ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਦੌੜਨ ਨਾਲ ਸਾਡੇ ਸਰੀਰ ਨੂੰ ਬਹੁਤ ਪ੍ਰਭਾਵ ਪੈਂਦੇ ਹਨ ਸਾਡਾ ਸਰੀਰ ਬਿਲਕੁਲ ਤੰਦਰੁਸਤ ਰਹਿੰਦਾ ਹੈ ਅਤੇ ਦੌੜਨਾ ਕਿਹੜੇ ਤਰੀਕੇ ਨਾਲ ਚਾਹੀਦਾ ਕਿੱਥੇ ਦੌੜਨਾ ਚਾਹੀਦਾ ਇਹ ਇਸ ਚੀਜ਼ ਬਾਰੇ ਜੇ ਅਸੀਂ ਸੋਚੀਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਕੁਦਰਤ ਦੇ ਵਿੱਚ ਦੌੜਨਾ ਚਾਹੀਦਾ ਹੈ ਸਾਨੂੰ ਪਾਰਕ ਦੇ ਵਿੱਚ ਦੌੜਨਾ ਚਾਹੀਦਾ ਹੈ ਜਿੱਥੇ ਕਿ ਚਿੜੀਆਂ ਦੀ ਚਹਿਕ ਹੋਵੇ ਉੱਥੇ ਸਾਨੂੰ ਇੱਕ ਸਕੂਨ ਮਹਿਸੂਸ ਹੁੰਦਾ ਸਾਡੇ ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ ਦੌੜਨ ਦਾ ਸਮਾਂ ਸਿਰਫ ਦੋ ਹੀ ਹੁੰਦੇ ਨੇ ਜਾਂ ਤਾਂ ਸੁਬਹਾ ਜਾਂ ਫਿਰ ਸ਼ਾਮ ਇਸ ਬਾਰੇ ਧਿਆਨ ਦੇਣਾ ਚਾਹੀਦਾ ਜਾਂ ਅਸੀਂ ਗਰਾਊਂਡ 'ਚ ਜਾ ਕੇ ਦੌੜ ਸਕਦੇ ਜਿੱਥੇ ਸਾਰੇ ਐਥਲੀਟ ਦੌੜਦੇ ਹਨ ਉਹ ਤਿਆਰੀ ਕਰਦੇ ਹਨ ਅੱਗੇ ਲੈਵਲ ਦੀ ਉਹਨਾਂ ਨਾਲ ਵੀ ਅਸੀਂ ਦੌੜ ਸਕਦੇ ਹਾਂ ਅਤੇ ਅਸੀਂ ਹੋਰ ਮੋਟੀਵੇਟ ਲਈ ਆਪਣੇ ਕੰਨਾਂ 'ਚ ਗਾਣੇ ਲਗਾ ਸਕਦੇ ਹਾਂ ਹੈਡਫੋਨ ਦਾ ਯੂਜ ਕਰ ਸਕਦੇ ਹਾਂ ਜਿੰਨਾਂ ਕਿ ਸਾਨੂੰ ਹੋਰ ਮੋਟੀਵੇਟ ਹੋਵੇ ਸਾਡੇ ਵਿੱਚ ਹੋਰ ਐਨਰਜੀ ਆਵੇ ਬੀਟ ਵਾਲੇ ਸੌਂਗ ਚੱਲਣ ਜੋ ਕਿ ਸਾਨੂੰ ਹੋਰ ਜ਼ਿਆਦਾ ਪ੍ਰਭਾਵਿਤ ਕਰਨ ਕਿ ਹਾਂ ਅੱਜ ਅਸੀਂ ਇਹ ਇੰਨਾਂ ਟਾਰਗੇਟ ਅਸੀਂ ਪੂਰਾ ਕਰਨਾ ਹੈ ਇਹ ਚੀਜ਼ ਅਸੀਂ ਅੱਜ ਕਰਨਾ ਹੀ ਹੈ ਸਟਾਰਟਿੰਗ ਦੇ ਵਿੱਚ ਜਦੋਂ ਅਸੀਂ ਦੌੜਦੇ ਹਾਂ ਤਾਂ ਸਾਡੇ ਪੈਰਾਂ 'ਚ ਖੱਲੀਆਂ ਪੈਂਦੀਆਂ ਵਾ ਸਾਡੇ ਪੈਰ ਦੁਖਦੇ ਆ ਸਾਡਾ ਸਰੀਰ ਦੁੱਖਦਾ ਵਾ ਸਾਨੂੰ ਥਕਾਨ ਮਹਿਸੂਸ ਹੁੰਦੀ ਆ ਪਰ ਇਹ ਸਭ ਚੀਜ਼ਾਂ ਥੋੜ੍ਹੇ ਟਾਈਮ ਲਈ ਹੀ ਹੁੰਦੀਆਂ ਨੇ ਜਦੋਂ ਅਸੀਂ ਰੋਜ਼ ਦੌੜਦੇ ਹਾਂ ਤਾਂ ਸਾਨੂੰ ਇਹਨਾਂ ਸਭ ਚੀਜ਼ਾਂ ਦੀ ਆਦਤ ਪੈ ਜਾਂਦੀ ਆ ਸਾਡੇ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਸਾਡਾ ਸਰੀਰ ਬਹੁਤ ਤੰਦਰੁਸਤ ਰਹਿੰਦਾ ਕੋਈ ਦਿੱਕਤ ਨਹੀਂ ਆਉਂਦੀ ਅਤੇ ਸਾਨੂੰ ਇੱਦਾਂ ਮਹਿਸੂਸ ਹੁੰਦਾ ਕਿ ਜੇ ਅਸੀਂ ਰਨਿੰਗ ਨਾ ਕਰਾਂਗੇ ਜੇ ਅਸੀਂ ਦੌੜਾਂਗੇ ਨਾ ਤਾਂ ਫਿਰ ਸਾਡਾ ਸਰੀਰ ਜਿਹੜਾ ਤੰਦਰੁਸਤ ਨਹੀਂ ਰਹੂਗਾ ਉਹ ਸਾਨੂੰ ਇੱਕ ਸੁਸਤੀ ਮਹਿਸੂਸ ਹੋਊਗੀ ਸਾਨੂੰ ਵਧੀਆ ਫੀਲ ਨਹੀਂ ਹੋਉਗਾ ਤਾਂ ਮੈਂ ਇਹ ਚਾਹੁੰਦੀ ਆ ਕਿ ਅੱਜ ਦੇ ਸਮੇਂ ਵਿੱਚ ਹਰ ਇੱਕ ਵਿਅਕਤੀ ਨੂੰ ਦੌੜਨਾ ਜ਼ਰੂਰ ਚਾਹੀਦਾ ਭਾਵੇਂ ਥੋੜ੍ਹਾ ਟਾਈਮ ਹੀ ਕਰੋ ਲੇਕਿਨ ਇਹਨਾਂ ਚੀਜ਼ਾਂ ਵੱਲ ਧਿਆਨ ਦਿਉ ਜਿੰਨਾਂ ਹੋ ਸਕੇ ਇੰਨਾਂ ਜ਼ਿਆਦਾ